ਮੇਰਾ ਪਸੰਦੀਦਾ ਕਲਾਕਾਰ ਕਰਨ ਔਜਲਾ ਹੈ ਜਿਸ ਵਿੱਚ ਬਹੁਤ ਸਾਰੇ ਗੁਣ ਹਨ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ਼ ਗਾਉਂਦਾ ਹੈ ਉਸਦੇ ਗਾਣੇ ਮੈਨੂੰ ਬਹੁਤ ਹੀ ਵਧੀਆ ਲੱਗਦੇ ਹਨ ਅਤੇ ਉਸਦੇ ਗਾਣੇ ਲੋਕਾਂ ਨੂੰ ਬਹੁਤ ਹੀ ਪ੍ਰਭਾਵਿਤ ਕਰਦੇ ਹਨ ਜਦੋਂ ਉਹ ਅਸਲੀ ਰੀਅਲ 'ਚ ਗਾਉਂਦਾ ਹੈ ਤਾਂ ਉਦੋਂ ਵੀ ਬਹੁਤ ਵਧੀਆ ਗਾਉਂਦਾ ਹੈ